ਹੈਲੋ ਹਰਮਨ ਅੰਮ੍ਰਿਤਸਰ ਕੁਲਚੇ ਵਾਲੇ ਮੈਂ ਲਵੇਸ਼ ਕੁਮਾਰ ਬਠਿੰਡਾ ਤੋਂ ਗੱਲ ਕਰ ਰਿਹਾ ਸਰ ਅਸੀਂ ਤੁਹਾਡੇ ਰੈਸਟੋਰੈਂਟ 'ਤੇ ਸੁਣਿਆ ਵੀ ਕੁਲਚੇ ਨੇ ਬਹੁਤ ਸੁਆਦ ਬਣਦੇ ਹਨ ਅਤੇ ਅਸੀਂ ਸਰ ਅੱਜ ਉਹ ਮੈਂ ਆਪਣੇ ਦੋਸਤ ਕੁਛ ਦੋਸਤਾਂ ਨਾਲ ਸਲਾਹ ਕੀਤੀ ਹੈ ਅਤੇ ਅਸੀਂ ਸਾਰੇ ਦੋਸਤ ਮਿਲ ਕੇ ਤੁਹਾਡੇ ਰੈਸਟੋਰੈਂਟ 'ਤੇ ਉਹ ਕੁਲਚੇ ਛੋਲੇ ਖਾਣ ਲਈ ਆ ਰਹੇ ਹਾਂ ਤੋ ਸਰ ਤੁਸੀਂ ਕਿਰਪਾ ਕਰਕੇ ਸਾਡਾ ਇਹ ਸੱਤ ਅੱਠ ਪਲੇਟਾਂ ਤਿਆਰ ਕਰਵਾ ਕੇ ਰੱਖ ਦਿਓ ਅਸੀਂ ਤੁਹਾਡੇ ਕੋਲ ਪੈਂਤੀ ਤੋਂ ਚਾਲੀ ਮਿੰਟ ਦੇ ਵਿੱਚ ਪਹੁੰਚ ਜਾਵਾਂਗੇ ਅਤੇ ਜਦੋਂ ਅਸੀਂ ਪਹੁੰਚਾਂਗੇ ਸਰ ਤੁਹਾਨੂੰ ਉਸ ਤੋਂ ਪਹੁੰਚਣ ਤੋਂ ਪਹਿਲਾਂ ਦਸ ਦਸ ਮਿੰਟ ਪਹਿਲਾਂ ਤੁਹਾਨੂੰ ਅਸੀਂ ਕਾਲ ਵੀ ਕਰਾਂਗੇ ਅਤੇ ਸਰ ਇੱਕ ਸਾਡੀ ਹੋਰ ਬੇਨਤੀ ਹੈ ਸਾਡੇ ਨਾਲ ਦੋ ਛੋਟੇ ਬੱਚੇ ਵੀ ਹੈ ਅਤੇ ਉਹਨਾਂ ਬੱਚਿਆਂ ਦੇ ਪਲੇਟ ਦੇ ਵਿੱਚ ਮਸਾਲੇ ਤਾਂ ਬਿਲਕੁਲ ਵੀ ਨਾ ਪਵਾਇਓ ਅਤੇ ਨਾ ਹੀ ਮਿਰਚ ਦੀ ਮਾਤਰਾ ਬਿਲਕੁਲ ਘੱਟ ਰੱਖਿਓ ਅਤੇ ਨਾਲੇ ਸਾਡੇ ਟੇਬਲ ਬਿਲਕੁਲ ਪਿੱਛੇ ਕੋਨੇ 'ਤੇ ਲਗਵਾ ਦਿਓ ਕਿਉਂਕਿ ਫਰੰਟ 'ਤੇ ਕੋਨੇ 'ਤੇ ਟੇਬਲ 'ਤੇ ਸਾਨੂੰ ਫੈਮਲੀ ਨਾਲ ਔਖਾ ਹੋ ਜਾਂਦਾ ਹੈ ਤੋ ਸੋ ਅਸੀਂ ਜਦੋਂ ਵੀ ਤੁਹਾਨੂੰ ਕਾਲ ਕਰਾਂਗੇ ਸਾਡਾ ਆਰਡਰ ਤਿਆਰ ਰੱਖਣਾ ਅਤੇ ਅਸੀਂ ਸਾਡੇ ਕੋਲ ਤੁਹਾਡਾ ਨੰਬਰ ਆਲਰੇਡੀ ਹੈ ਸਰ ਅਤੇ ਅਸੀਂ ਤੁਹਾਡੇ ਕੋਲ ਪਹੁੰਚ ਕੇ ਤੁਹਾਨੂੰ ਕਾਲ ਕਰ ਦੇਵਾਂਗੇ ਧੰਨਵਾਦ ਸਰ